ਟੈਕਨੋਲੋਜੀ ਨਾਲ ਜਿਹੜੇ ਛੋਟੇ ਪੱਧਰ ਦੇ ਘਰਾਂ ਵਿੱਚ ਹੱਥਾਂ ਨਾਲ ਕੰਮ ਕਰਨ 'ਤੇ ਬਹੁਤ ਜ਼ਿਆਦਾ ਸਮਾਂ ਲਗਾਇਆ ਜਾਂਦਾ ਸੀ ਟੈਕਨੋਲੋਜੀ ਨੇ ਉਸ ਚੀਜ਼ ਦੀਆਂ ਮਸ਼ੀਨਾਂ ਆ ਗਈਆਂ ਨੇ ਤਾਂ ਕੱਪੜਾ ਬੁਣਨ ਵਾਲੀਆਂ ਮਸ਼ੀਨਾਂ ਦਾ ਉਸਨੇ ਕੀ ਹੈ ਲੋਕਾਂ ਦਾ ਕੰਮ ਘਟਾਇਆ ਹੈ ਕਣਕਾਂ ਸਾਫ ਕਰਨ ਵਾਲੀਆਂ ਪੀਸਣ ਵਾਲੀਆਂ ਪਹਿਲਾਂ ਹੱਥਾਂ ਨਾਲ ਕੰਮ ਕੀਤਾ ਜਾਂਦਾ ਸੀ ਤਾਂ ਉਸ 'ਤੇ ਬਹੁਤ ਜ਼ਿਆਦਾ ਸਮਾਂ ਬਰਬਾਦ ਹੁੰਦਾ ਸੀ ਪਰ ਹੁਣ ਮਸ਼ੀਨਾਂ ਨਾਲ ਜਿਹੜਾ ਕੰਮ ਪਹਿਲਾਂ ਘੰਟਿਆਂ ਵਿੱਚ ਹੁੰਦਾ ਸੀ ਹੁਣ ਮਿੰਟਾਂ ਵਿੱਚ ਹੋ ਜਾਂਦਾ ਤਾਂ ਇਸ ਨਾਲ ਕੀ ਹੈ ਛੋਟੇ ਕਾਰੋਬਾਰ ਉਹ ਇੱਕ ਮਸ਼ੀਨ ਲਗਾ ਕੇ ਆਪਣਾ ਕੰਮ ਬਹੁਤ ਜ਼ਿਆਦਾ ਵਧਾ ਸਕਦੇ ਆ ਅਤੇ ਘੱਟ ਸਮੇਂ ਵਿੱਚ ਕਰ ਸਕਦੇ ਹੈ ਅਤੇ ਹੋਰ ਅੱਜ ਕੱਲ੍ਹ ਐਡਵਰਟਾਈਜਮੈਂਟ ਹੋ ਜਾਂਦੀਆਂ ਨੇ ਛੋਟੇ ਕਾਰੋਬਾਰਾਂ ਨੂੰ ਉਤਸ਼ਾਹ ਮਿਲਦਾ ਟੈਕਨੋਲੋਜੀ ਨਾਲ ਟੈਕਨੋਲੋਜੀ ਨਾਲ ਕੀ ਹੈ ਪਹਿਲਾਂ ਰੇਡੀਓ ਹੁੰਦੇ ਸਨ ਹੁਣ ਟੀ ਵੀ ਵਿੱਚ ਤੁਸੀਂ ਪ੍ਰਦਰਸ਼ਨੀ ਵੀ ਕਰ ਸਕਦੇ ਹੋ ਆਪਣੇ ਕਾਰੋਬਾਰ ਦੀ ਜਿਸ ਨਾਲ ਛੋਟੇ ਪੱਧਰ 'ਤੇ ਕੀਤੇ ਗਏ ਕਾਰੋਬਾਰ ਨੂੰ ਕਾਫੀ ਜ਼ਿਆਦਾ ਉਤਸ਼ਾਹ ਮਿਲਦਾ ਹੈ ਟੈਕਨੋਲੋਜੀ ਦੇ ਜਿੱਥੇ ਨੁਕਸਾਨ ਹਨ ਉੱਥੇ ਫਾਇਦੇ ਵੀ ਬਹੁਤ ਹਨ